ਕਈ ਗੀਤ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਵਾਰ ਵਾਰ ਸੁਣਨ ਵੇਲੇ ਵੀ ਮਨ ਨਹੀਂ ਭਰਦਾ ਦਿਲ ਨਹੀਂ ਭਰਦਾ ਕਿਉਂਕਿ ਉਹਨਾਂ ਦੀ ਲਿਖਣੀ ਉਹਨਾਂ ਦੀ ਗਾਇਕੀ ਉਹਨਾਂ ਦੇ ਸ਼ਬਦ ਉਹਨਾਂ ਦੀ ਰਚਨਾ ਉਹਨਾਂ ਦੀ ਕੰਪੋਜੀਸ਼ਨ ਇੰਨੀ ਕੁ ਵਧੀਆ ਹੁੰਦੀ ਹੈ ਕਿ ਤੁਹਾਡੇ ਸਿੱਧੇ ਦਿਲ ਵਿੱਚ ਉਤਰ ਜਾਂਦੇ ਆ ਮੇਰੇ ਪਸੰਦੀਦਾ ਗੀਤ ਵੀ ਕਈ ਰਹੇ ਹਨ ਜਿਵੇਂ ਮੇਰੇ ਚਰਖੇ ਦੀ ਟੁੱਟ ਗਈ ਮਾਲ੍ਹ ਵੇ ਚੰਨ ਕੱਤਾਂ ਕੇ ਨਾ ਹਾਕਮ ਸੂਫੀ ਜੀ ਦਾ ਗਾਇਆ ਹੋਇਆ ਗੀਤ ਹੈ ਬਹੁਤ ਹੀ ਜ਼ਿਆਦਾ ਪਿਆਰਾ ਗੀਤ ਬਹੁਤ ਵਾਰ ਸੁਣਿਆ ਅਤੇ ਬਹੁਤ ਵਾਰੀ ਮੈਂ ਆਪ ਵੀ ਸਟੇਜਾਂ 'ਤੇ ਇਸ ਦੀ ਪੇਸ਼ਕਾਰੀ ਕੀਤੀ ਹੈ ਅਤੇ ਮੈਨੂੰ ਵੀ ਕਾਫੀ ਵਾਹ ਵਾਹ ਵਾਹ ਵਾਹ ਵਾਈ ਮਿਲੀ ਹੈ ਇੱਕ ਹੋਰ ਗੀਤ ਸੀ ਘੱਗਰੇ ਵੀ ਗਏ ਫੁਲਕਾਰੀਆਂ ਵੀ ਗਏ ਗੁਰਦਾਸ ਮਾਨ ਜੀ ਦਾ ਗੀਤ ਹੈ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਬਹੁਤ ਹੀ ਲੋਕਾਂ ਦੀ ਜ਼ੁਬਾਨ ਉੱਤੇ ਚੜ੍ਹਿਆ ਹੋਇਆ ਗੀਤ ਹੈ ਕਿ ਲੋਕ ਵੀ ਇਸਨੂੰ ਵਾਰ ਵਾਰ ਸੁਣਨਾ ਪਸੰਦ ਕਰਦੇ ਹਨ ਇੱਕ ਹੋਰ ਗੀਤ ਸੀ ਹਾਕਮ ਸੂਫੀ ਜੀ ਦਾ ਗਾਇਆ ਹੋਇਆ ਪਾਣੀ ਵਿੱਚ ਮਾਰਾਂ ਡੀਠਾਂ ਕਰਦੀ ਪਈ ਰੋਜ਼ ਉਡੀਕਾਂ ਰਾਂਝਣ ਮਿਲਵਾ ਦੇ ਰੱਬਾ ਪਾਵੀ ਨਾ ਦੂਰ ਤਰੀਕਾਂ ਵਿਛੜਿਆ ਯਾਰ ਮਿਲਾ ਦੇ ਵੇ ਇਹ ਗੀਤ ਬਹੁਤ ਪਾਪੂਲਰ ਹੋਇਆ ਸੀ ਬਹੁਤ ਮਸ਼ਹੂਰ ਹੋਇਆ ਸੀ ਹਾਕਮ ਸੂਫੀ ਜੀ ਦਾ ਅਤੇ ਮੈਨੂੰ ਵੀ ਇਹ ਕਈ ਵਾਰੀ ਸਟੇਜਾਂ ਉੱਤੇ ਗਾਉਣ ਦਾ ਮੌਕਾ ਮਿਲਿਆ ਇੱਕ ਹੋਰ ਗੀਤ ਮੇਰੇ ਬਹੁਤ ਜ਼ਿਆਦਾ ਜਿਹੜਾ ਮੈਨੂੰ ਵਧੀਆ ਲੱਗਦਾ ਇਹ ਦੁਨੀਆਂ ਮੰਡੀ ਪੈਸੇ ਦੀ ਹਰ ਚੀਜ਼ ਵਿਕੇਂਦੀ ਭਾਅ ਸੱਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਸੱਜਣਾ ਕਿੰਨੇ ਸੋਹਣੇ ਸ਼ਬਦਾਂ ਦੇ ਵਿੱਚ ਉਕਰਿਆ ਹੋਇਆ ਗੀਤ ਹੈ ਅਤੇ ਕਿੰਨੀ ਹੀ ਜ਼ਿਆਦਾ ਇਹਦੀ ਕੰਪੋਜੀਸ਼ਨ ਵਧੀਆ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਮਾਮਲਾ ਗੜਬੜ ਹੈ ਦਿਲ ਦਾ ਮਾਮਲਾ ਹੈ ਗੁਰਦਾਸ ਮਾਨ ਜੀ ਦੇ ਗੀਤ ਨੇ ਅਤੇ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਗੀਤ ਹੋਇਆ ਸੀ ਸੈਡ ਸੌਂਗ ਦੇ ਵਜੋਂ ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਹਾਂ ਦੋਸਤਾਂ ਦੀ ਦੋਸਤੀ ਦੇ ਨਾਮ ਕਰ ਚੱਲੇ ਹਾਂ ਬੜੇ ਹੀ ਵਿਲੱਖਣ ਅੰਦਾਜ਼ ਦੇ ਵਿੱਚ ਗਾਇਆ ਹੋਇਆ ਗੀਤ ਜਿਹੜਾ ਵਾਰ ਵਾਰ ਅਤੇ ਰਾਤਾਂ ਨੂੰ ਬਹਿ ਕੇ ਸੁਣਨ ਵਾਲਾ ਗੀਤ ਹੈ ਇਹੋ ਜਿਹੇ ਗੀਤ ਕਦੇ ਵੀ ਮੰਨ 'ਚੋ ਨਹੀਂ ਉਤਰਦੇ ਦਿਲ ਕਰਦਾ ਕਿ ਇਹਨਾਂ ਨੂੰ ਵਾਰੀ ਵਾਰੀ ਸੁਣੀ ਜਾਈਏ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਪੁਰਾਣੇ ਗੀਤ ਸੀ ਉਹ ਬਹੁਤ ਹੀ ਜ਼ਿਆਦਾ ਵਧੀਆ ਸੀ ਸੁਣਨ ਵਿੱਚ ਅੱਜ ਦੀ ਗਾਇਕੀ ਦਾ ਥੋੜ੍ਹਾ ਜਿਹਾ ਫਰਕ ਪੈ ਗਿਆ ਅੱਜ ਦੇ ਗੀਤ ਨੇ ਥੋੜ੍ਹੇ ਜਿਹੇ ਫਰਕ ਪੈ ਗਏ ਪਹਿਲਾਂ ਇਕੱਲੀ ਆਵਾਜ਼ ਸੁਣਦੀ ਸੀ ਪਰ ਅੱਜ ਕੱਲ੍ਹ ਜਿਹੜੇ ਸਾਜਾਂ ਦਾ ਜਿਹੜਾ ਪ੍ਰਭਾਵ ਉਹ ਗੀਤਾ ਦੇ ਉੱਤੇ ਹਾਵੀ ਹੋ ਗਿਆ ਕਲਾਕਾਰ ਦੀ ਆਵਾਜ਼ ਦੱਬ ਕੇ ਰਹਿ ਜਾਂਦੀ ਹੈ ਪਰ ਉਹਨੂੰ ਕੰਪਿਊਟਰ ਦੇ ਇਸ ਯੁੱਗ ਦੇ ਵਿੱਚ ਉਭਾਰ ਲਿਆ ਜਾਂਦਾ ਪਰ ਅਸਲੀ ਗਾਇਕੀ ਤਾਂ ਉਹ ਹੁੰਦੀ ਹੈ ਜਿਹੜੀ ਸਟੇਜ ਦੇ ਉੱਤੇ ਬਿਨਾਂ ਮਾਈਕ ਤੋਂ ਵੀ ਦਰਸ਼ਕਾਂ ਦੇ ਦਿਲ ਵਿੱਚ ਉਤਰ ਜਾਵੇ ਹੋਰ ਵੀ ਅਨੇਕਾਂ ਗੀਤ ਹਨ ਹਿੰਦੀ ਦੇ ਗੀਤ ਵੀ ਹਨ ਪੰਜਾਬੀ ਦੇ ਗੀਤ ਵੀ ਹਨ ਜਿਹੜੇ ਕਿ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ ਮੇਰੇ ਪਸੰਦੀਦਾ ਗਾਇਕ ਗੁਰਦਾਸ ਮਾਨ ਹਨ ਜਿਹਨਾਂ ਦੇ ਬਹੁਤ ਜ਼ਿਆਦਾ ਗੀਤ ਮੈਂ ਸੁਣਦਾ ਰਹਿੰਦਾ ਅਕਸਰ ਇਹ ਗੀਤ ਮੈਂ ਯੂਟੀਊਬ ਐਮਾਜੋਨ ਮਿਊਜ਼ਿਕ ਸਪੋਟੀਫਾਈ ਇਹੋ ਜਿਹੀਆਂ ਐਪਸ ਦੇ ਉੱਤੇ ਹਮੇਸ਼ਾ ਸੁਣਦਾ ਰਹਿੰਦਾ ਹਾਂ ਅਤੇ ਮੈਨੂੰ ਇਵੇਂ ਲੱਗਦਾ ਜਿਵੇਂ ਇਹ ਮੇਰੇ ਅੰਗ ਸੰਗ ਹੀ ਹੋਣ ਅਤੇ ਮੇਰੇ ਚਰਿੱਤਰ ਨੂੰ ਅਤੇ ਮੇਰੇ ਗਾਇਕੀ ਨੂੰ ਵੀ ਇਹ ਪਰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ ਸੋ ਨਿਆਰੀ ਗੀਤ ਸੁਣਨਾ ਇੱਕ ਬਹੁਤ ਵਧੀਆ ਗੱਲ ਹੈ ਤਾਂ ਕਿ ਸਾਡੇ ਸੱਭਿਆਚਾਰ ਨੂੰ ਹੋਰ ਸੇਧ ਮਿਲ ਸਕੇ ਧੰਨਵਾਦ